ਜੇਕਰ ਸਾਡੇ ਪਿੰਡ 'ਚ ਕਿਸੇ ਨੂੰ ਸੱਪ ਲੜ ਗਿਆ ਤਾਂ ਅਸੀਂ ਉਸ ਨੂੰ ਸਭ ਤੋਂ ਪਹਿਲਾਂ ਉਸ ਦੇ ਜਿੱਥੇ ਸੱਪ ਲੜਿਆ ਉੱਥੇ ਸੱਪ ਦ ਦੇ ਡੰਗਣ ਵਾਲੀ ਥਾਂ ਤੋਂ ਉਪਰ ਲੱਤ ਨੂੰ ਚੰਗੀ ਤਰ੍ਹਾਂ ਬੰਨਾਂਗੇ ਅਤੇ ਉਸ ਤੋਂ ਬਾਅਦ ਉਸ 'ਤੇ ਥੋੜ੍ਹਾ ਜਿਹਾ ਟੱਕ ਲਾਵਾਂਗੇ ਤਾਂ ਜੋ ਗੰਦਾ ਖੂਨ ਆ ਉਹ ਬਾਹਰ ਆ ਜੂਗਾ ਅਤੇ ਉਸ ਤੋਂ ਬਾਅਦ ਅਸੀਂ ਆਪਣੇ ਨੇੜੇ ਤੇੜੇ ਦੇ ਡਾਕਟਰ ਵਧੀਆ ਡਾਕਟਰ ਨੂੰ ਫੋਨ ਕਰਾਂਗੇ ਜਾਂ ਅਸੀਂ ਉਸ ਵਿਅਕਤੀ ਨੂੰ ਆਪ ਲੈ ਕੇ ਜਾਵਾਂਗੇ ਅਤੇ ਉਸਨੂੰ ਵਿੱਚ ਵਿੱਚ ਪਾਣੀ ਵੀ ਦਿੰਦੇ ਰਹਾਂਗੇ ਅਤੇ ਹੌਸਲਾ ਵੀ ਦਿੰਦੇ ਰਹਾਂਗੇ ਜਾਂ ਉਹ ਤਾਂ ਜੋ ਉਹ ਗੱਲ ਉਸ ਬਾਰੇ ਸੋਚ ਨਾ ਸਕੇ ਕੀ ਉਸਨੂੰ ਸੱਪ ਨੇ ਲੜਿਆ ਹੈ ਅਤੇ ਉਹਨੂੰ ਡਾਕਟਰ ਕੋਲ ਲੈ ਕੇ ਜਾਵਾਂਗੇ ਅਤੇ ਦਵਾਈ ਵਧੀਆ ਦਵਾਵਾਂਗੇ ਅਤੇ ਉਸਦਾ ਇਲਾਜ ਵਧੀਆ ਹਸਪਤਾਲ ਅਤੇ ਵਧੀਆ ਡਾਕਟਰ ਕੋਲੋਂ ਕਰਵਾਵਾਂਗੇ